ਹਾਂ ਮੈਂ ਆਪਣੇ ਘਰ ਵਿੱਚ ਕਈ ਤਰ੍ਹਾਂ ਦੀ ਇਲੈਕਟਰੋਨਿਕ ਚੀਜ਼ਾਂ ਵਰਤੀਆਂ ਹਨ ਜਿਵੇਂ ਕਿ ਏ ਸੀ ਵੋਸ਼ਿੰਗ ਮਸ਼ੀਨ ਟੀ ਵੀ ਕੰਪਿਊਟਰ ਮਾਈਕ੍ਰਵੇਅਰ ਇੰਡਕਸ਼ਨ ਏ ਸੀ ਏ ਸੀ ਮੈਂ ਤਾਂ ਖਰੀਦਿਆ ਸੀ ਕਿਉਂਕਿ ਸਾਡੇ ਇੱਧਰ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਅਤੇ ਘਰਦੇ ਵੀ ਵਾਰ ਵਾਰ ਬਹੁਤ ਤੰਗ ਹੋ ਰਹੇ ਸੀ ਕਿ ਬਹੁਤ ਜ਼ਿਆਦਾ ਗਰਮੀ ਹੈ ਅ ਇੱਕ ਦੋ ਵਾਰੀ ਘਰਦੇ ਵੀ ਬਿਮਾਰ ਪੈ ਗਏ ਸੀ ਤਾਂ ਕਰਕੇ ਮੈਂ ਏ ਸੀ ਖਰੀਦਿਆ ਅਤੇ ਟੀ ਵੀ ਤਾਂ ਕਰਕੇ ਖਰੀਦਿਆ ਸੀ ਕਿ ਮੈਂ ਗੇਮਿੰਗ ਬਹੁਤ ਚੰਗੀ ਲੱਗਦੀ ਮੈਨੂੰ ਗੇਮਿੰਗ ਖੇਡਣੀ ਗੇਮ ਕਰਨਾ ਵਗੈਰਾ ਪਲੇਅ ਸਟੇਸ਼ਨ ਖੇਡਣਾ ਅਤੇ ਘਰ ਘਰ ਦੇ ਵੀ ਫਰੀ ਟਾਈਮ 'ਚ ਕੁਛ ਨਹੀਂ ਕਰਦੇ ਸੀ ਤਾਂ ਕਰਕੇ ਮੈਂ ਉਹਨਾਂ ਵਾਸਤੇ ਵੀ ਇੱਕ ਟੀ ਵੀ ਲਿਆ ਅਤੇ ਉਹ ਫਰੀ ਟਾਈਮ ਵਿੱਚ ਨਿਊਜ਼ ਨਿਊਜ਼ ਵਗੈਰਾ ਸੀਰੀਅਲ ਵਗੈਰਾ ਦੇਖਦੇ ਹਨ ਅਤੇ ਮੈਂ ਇੱਕ ਟੀ ਵੀ ਆਪਣੇ ਰੂਮ 'ਚ ਲਾਇਆ ਅਤੇ ਮੈਂ ਉਸ ਵਿੱਚ ਪਲੇਅ ਸਟੇਸ਼ਨ ਵਗੈਰਾ ਗੇਮਿੰਗ ਖੇਡਦਾ ਸਮੈਕਡਾਊਨ ਵਗੈਰਾ ਵੋਸ਼ਿੰਗ ਮਸ਼ੀਨ ਵੋਸ਼ਿੰਗ ਮਸ਼ੀਨ ਤਾਂ ਮੈਂ ਬਾਏ ਕੀਤੀ ਸੀ ਇਹ ਕੁਛ ਟੂ ਜਾਂ ਥਰੀ ਮੰਥ ਪਹਿਲਾਂ ਬਾਏ ਕੀਤੀ ਸੀ ਕਿਉਂਕਿ ਬਹੁਤ ਜ਼ਿਆਦਾ ਘਰ ਦੇ ਕੱਪੜੇ ਹੁੰਦੇ ਸੀ ਅਤੇ ਮੰਮਾ ਕੱਪੜੇ ਧੋ ਧੋ ਕੇ ਬਿਮਾਰ ਪੈ ਜਾਂਦੇ ਤਾਂ ਕਰਕੇ ਮੈਂ ਵੋਸ਼ਿੰਗ ਮਸ਼ੀਨ ਬਾਏ ਕੀਤੀ ਸੀ ਕਿ ਮੰਮਾ ਨੂੰ ਆਸਾਨੀ ਹੋਵੇਗੀ ਅਤੇ ਕੱਪੜੇ ਧੋਣ 'ਚ ਵੀ ਆਸਾਨੀ ਹੋਵੇਗੀ ਅਤੇ ਮੈਂ ਫੁੱਲ ਆਟੋਮੈਟਿਕ ਵੋਸ਼ਿੰਗ ਮਸ਼ੀਨ ਬਾਏ ਕੀਤੀ ਸੀ ਜਿਸ ਵਿੱਚ ਉਹ ਖੁਦ ਹੀ ਪਾਣੀ ਲੈਂਦਾ ਸੀ ਖੁਦ ਹੀ ਸਰਫ਼ ਲੈਂਦਾ ਸੀ ਖੁਦ ਹੀ ਸਭ ਕੁਛ ਕਰ ਦਿੰਦਾ ਬਸ ਆਪਾਂ ਕੱਪੜੇ ਕੁ ਕੱਢ ਕੇ ਸੁਕਾਉਣੇ ਹੁੰਦੇ ਸੀ ਸਭ ਕੁਛ ਉਹ ਹੀ ਕਰ ਦਿੰਦਾ ਸੀ ਅਤੇ ਮਾਈਕਰੋਵੇਵ ਮਾਈਕਰੋਵੇਵ ਤਾਂ ਲਿਆ ਸੀ ਕਿਉਂਕਿ ਕਈ ਵਾਰੀ ਰਾਤ ਦਾ ਵੀ ਖਾਣਾ ਕੁਛ ਵੀ ਬਚ ਜਾਂਦਾ ਸੀ ਦੈਨ ਉਹਨੂੰ ਗੈਸ 'ਤੇ ਗਰਮ ਕਰਨ ਦੀ ਥਾਂ 'ਤੇ ਆਪਾਂ ਮਾਈਕਰੋਵੇਵ 'ਤੇ ਗਰਮ ਕਰ ਲੈਂਦੇ ਸੀ ਕਿਉਂਕਿ ਗੈਸ ਵੇਸਟ ਹੁੰਦੀ ਸੀ ਅਤੇ ਆਪਾਂ ਮਾਈਕਰੋਵੇਵ 'ਤੇ ਜਲਦੀ ਗਰਮ ਹੋ ਜਾਂਦਾ ਸੀ ਅਤੇ ਮਾਈਕਰੋਵੇਵ ਤੋਂ ਤੇਲ ਤੋਂ ਵੀ ਬਚਿਆ ਜਾਂਦਾ ਕਿਉਂਕਿ ਤੇਲ ਤੋਂ ਸਾਨੂੰ ਬਹੁਤ ਨੁਕਸਾਨਦਾਇਕ ਹੁੰਦਾ